ਘਰ ਦੇ ਵਿੱਚ ਰਹਿ ਕੇ ਸਭ ਕੁਛ ਨਹੀਂ ਮਿਲਦਾ ਆਪਾਂ ਨੂੰ ਵੱਖ ਵੱਖ ਜਗ੍ਹਾ 'ਤੇ ਘੁੰਮਣਾ ਚਾਹੀਦਾ ਹੈਗਾ ਬਟ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈਗਾ ਗਾ ਬਹੁਤ ਜ਼ਿਆਦਾ ਵਧੀਆ ਲੱਗਿਆ ਅੰਮ੍ਰਿਤਸਰ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਇਤਿਹਾਸਿਕ ਚੀਜ਼ਾਂ ਬਾਰੇ ਜਾਣਨਾ ਮੈਨੂੰ ਵਧੀਆ ਲੱਗਦਾ ਇਤਿਹਾਸਿਕ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਨੂੰ ਪਸੰਦ ਨੇ ਮੈਨੂੰ ਵੇਖਣਾ ਵੀ ਪਸੰਦ ਹੈ ਔਰ ਮੈਨੂੰ ਉਹਨਾਂ ਚੀਜ਼ਾਂ ਬਾਰੇ ਜਾਣਨਾ ਵੀ ਬਹੁਤ ਜ਼ਿਆਦਾ ਪਸੰਦ ਹੈ ਜਿੱਦਾਂ ਕਿ ਆਪਣਾ ਹੋ ਗਿਆ ਗੋਲਡਨ ਟੈਂਪਲ ਹੋ ਗਿਆ ਹੈ ਨਾ ਗੁਰੂ ਘਰ ਹੋ ਗਿਆ ਉੱਥੇ ਘੁੰਮਣਾ ਫਿਰਨਾ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਕਿ ਉੱਥੇ ਵੇਖਣ ਨੂੰ ਚੀਜ਼ਾਂ ਜਿਵੇਂ ਕਿ ਜਲ੍ਹਿਆਂ ਵਾਲਾ ਬਾਗ ਹੋ ਗਿਆ ਹੈ ਨਾ ਮੈਂ ਉੱਥੇ ਗਈ ਹਾਂ ਉੱਥੇ ਮੈਨੂੰ ਸਾਰਾ ਕੁਝ ਦੇਖ ਕੇ ਬਹੁਤ ਵਧੀਆ ਲੱਗਦਾ ਜਿਹੜਾ ਕਿ ਮੈਂ ਕਦੇ ਨਹੀਂ ਭੁੱਲ ਸਕਦੀ ਹੈ ਨਾ ਜਲ੍ਹਿਆਂ ਵਾਲਾ ਬਾਗ ਹੋ ਗਿਆ ਹੋਰ ਵੀ ਬਹੁਤ ਵੱਖ ਵੱਖ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਕਿ ਨਹੀਂ ਭੁੱਲਣਯੋਗ ਹੈਗੀਆਂ ਜਿਹੜੀਆਂ ਕਿ ਆਪਾਂ ਨੂੰ ਵਧੀਆ ਲੱਗਦੀਆਂ ਨੇ ਵੇਖਣੀਆਂ ਉੱਥੇ ਬਹੁਤ ਸਾਰੀਆਂ ਜਗ੍ਹਾ ਨੇ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਕਿ ਵੀ ਹੋ ਗਿਆ ਸਭ ਤੋਂ ਜ਼ਿਆਦਾ ਬੈਸਟ ਉੱਥੇ ਜਲ੍ਹਿਆਂ ਵਾਲਾ ਬਾਗ ਹੈ ਜਿਹੜਾ ਕਿ ਮੈਨੂੰ ਸਭ ਤੋਂ ਬੈਸਟ ਲੱਗਿਆ ਗੁਰੂ ਘਰ ਹੋ ਗਿਆ ਅੰਮ੍ਰਿਤਸਰ ਇਤਿਹਾਸਿਕ ਹੈ ਉਹ ਵਧੀਆ ਹੋ ਗਿਆ ਬਾਕੀ ਹੋਰ ਵੀ ਵੱਖ ਵੱਖ ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਇਤਿਹਾਸਿਕ ਨੇ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਸਭ ਤੋਂ ਬੈਸਟ ਅੰਮ੍ਰਿਤਸਰ